ਭਾਰਤ ਇੱਕ ਬਹੁਤ ਵੱਡਾ ਅਤੇ ਵਿਕਸਿਤ ਦੇਸ਼ ਹੈ ਇੱਥੇ ਬਹੁਤ ਸਾਰੀਆਂ ਥਾਵਾਂ ਹਨ ਜੋ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ ਇੱਥੇ ਸਾਡੇ ਦੇਸ਼ ਦੇ ਲੋਕ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਘੁੰਮਣ ਆਉਂਦੇ ਹਨ ਚੰਡੀਗੜ੍ਹ ਦਾ ਰੌਕ ਗਾਰਡਨ ਜਿੱਥੇ ਅਦਭੁਤ ਢੰਗ ਨਾਲ਼ ਕਲਾਕ੍ਰਿਤੀ ਦਾ ਪ੍ਰਦਰਸ਼ਨ ਕੀਤਾ ਹੋਇਆ ਹੈ ਵਿਰਾਸਤ ਏ ਖਾਲਸਾ ਜਿੱਥੇ ਸਿੱਖ ਇਤਿਹਾਸ ਬਾਰੇ ਬੜੀ ਡੂੰਘਾਈ ਨਾਲ਼ ਦੱਸਿਆ ਗਿਆ ਹੈ ਆਗਰੇ ਦਾ ਤਾਜ ਮਹਿਲ ਦਿੱਲੀ ਦਾ ਲਾਲ ਕਿਲ੍ਹਾ ਅਤੇ ਇੰਡੀਆ ਗੇਟ ਆਦਿ ਵੇਖਣ ਯੋਗ ਸਥਾਨ ਹਨ ਅਤੇ ਧਾਰਮਿਕ ਸਥਾਨ ਜਿਵੇਂ ਕਿ ਹਰਿਮੰਦਰ ਸਾਹਿਬ ਮਾਤਾ ਨੈਣਾ ਦੇਵੀ ਮੰਦਰ ਜਗਨਨਾਥ ਪੁਰੀ ਪਟਨਾ ਸਾਹਿਬ ਲਈ ਦੇਖਣ ਲਈ ਲੋਕ ਬਹੁਤ ਦੂਰੋਂ ਬੜੀ ਸ਼ਰਧਾ ਦੇ ਨਾਲ਼ ਆਉਂਦੇ ਹਨ ਇੱਥੇ ਬਹੁਤ ਹੀ ਧਾਰਮਿਕ ਸਥਾਨ ਹਨ ਜਾਂ ਮਨੋਰੰਜਨ ਸਥਾਨ ਜਿਨ੍ਹਾਂ ਜਿਹੜੇ ਕਿ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ